ਯੋਗ ਅਭਿਆਸ ਵਿੱਚ ਧਿਆਨ ਦੀ ਭੂਮਿਕਾ ਬਹੁਤ ਵੱਡੀ ਹੁੰਦੀ ਹੈ ਅਸੀਂ ਜਦੋਂ ਧਿਆਨ ਵਿੱਚ ਬੈਠਦੇ ਹਾਂ ਯੋਗਾ ਕਰਦੇ ਹੋਏ ਸਾਡਾ ਪੂਰਾ ਸਰੀਰ ਇਕਾਂਤ ਸ਼ਾਂਤ ਹੁੰਦਾ ਹੈ ਬਿਲਕੁਲ ਅਸੀਂ ਪੁ ਪਰਮਾਤਮਾ ਦੇ ਨਾਲ ਉਸ ਟਾਈਮ ਜੁੜੇ ਹੁੰਦੇ ਹਾਂ ਸਾਡਾ ਧਿਆਨ ਪੂਰਾ ਪਰਮਾਤਮਾ ਦੇ ਵਿੱਚ ਲੀਨ ਹੁੰਦਾ ਹੈ ਅਸੀਂ ਆਪਣੇ ਸਰੀਰ ਵਿੱਚ ਇੱਕ ਊਰਜਾ ਮਹਿਸੂਸ ਕਰ ਸਕਦੇ ਹਾਂ ਜੋ ਕਿ ਸਾਨੂੰ ਪਰਮਾਤਮਾ ਨਾਲ ਮਿਲਾ ਰਹੀ ਹੁੰਦੀ ਹੈ ਜਦੋਂ ਇਹ ਊਰਜਾ ਸਾਡੇ ਵਿੱਚ ਜ਼ਿਆਦਾ ਹੁੰਦੀ ਹੈ ਤਾਂ ਸਾਡੇ ਮੱਥੇ ਦੇ ਵਿਚਕਾਰ ਗੋਲ ਗੋਲ ਗੋਲ ਗੋਲ ਸਰਕਲ ਘੁੰਮਦਾ ਹੈ ਜੋ ਕਿ ਸਾਨੂੰ ਮੈਡੀਟੇਸ਼ਨ ਲਈ ਬਹੁਤ ਵਧੀਆ ਕਰਦਾ ਹੈ ਲੱਗਦਾ ਹੈ